ਪੰਜਾਬੀ ਭਾਸ਼ਾ ਜੋ ਕ ਸਾਡੀ ਸਥਾਨਕ ਅਤੇ ਆਰਥਿਕ ਭਾਸ਼ਾ ਹੈ ਇਹ ਸਾਡੇ ਵਪਾਰਾਂ ਵਿੱਚ ਵਣਜ ਵਿੱਚ ਹਰ ਜਗ੍ਹਾ ਯੂਜ ਹੁੰਦੀ ਹੈ ਪੰਜਾਬੀ ਭਾਸ਼ਾ ਸਾਡੀ ਮੇਨ ਭਾਸ਼ਾ ਹੈ ਸਾਡੇ ਪੰਜਾਬ ਦੇ ਵੱਖ ਵੱਖ ਰਾਜਾਂ ਵਿੱਚ ਹਰ ਜਗ੍ਹਾ ਵਿੱਚ ਬੋਲਣ ਵਾਲੀ ਭਾਸ਼ਾ ਹੈ ਸਾਡੀ ਜਿਹੜੀ ਪੰਜਾਬੀ ਭਾਸ਼ਾ ਉਸ ਹਰ ਇੱਕ ਜਗ੍ਹਾ ਬੋਲੀ ਜਾਂਦੀ ਹੈ ਕਿਉਂਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਭਾਸ਼ਾ ਨੂੰ ਸਮਝਣਾ ਬਹੁਤ ਹੀ ਆਸਾਨ ਹੋ ਜਾਂਦਾ ਉਹਨਾਂ ਲਈ ਪੰਜਾਬੀ ਭਾਸ਼ਾ ਜੋ ਹੈ ਬਹੁਤ ਹੀ ਵਧੀਆ ਪਿਆਰ ਵਾਲੀ ਭਾਸ਼ਾ ਹੈ ਅਤੇ ਅਸੀਂ ਇਹਨੂੰ ਬੋਲ ਵੀ ਚੰਗੀ ਤਰ੍ਹਾਂ ਲੈਂਦੇ ਹਾਂ ਸਮਝ ਵੀ ਚੰਗੀ ਤਰ੍ਹਾਂ ਲੈਂਦੇ ਹਾਂ ਸਾਡੇ ਵੱਖ ਵੱਖ ਰਾਜਾਂ ਵਿੱਚ ਇਸਦੀ ਵਰਤੋਂ ਹੁੰਦੀ ਹੈ ਵੱਖ ਵੱਖ ਡਿਸਟਰਿਕਟਸ ਦੇ ਵਿੱਚ ਜ਼ਿਲਿਆਂ ਵਿੱਚ ਇਹਦੀ ਵਰਤੋਂ ਹੁੰਦੀ ਹੈ ਮੋਹਾਲੀ ਚੰਡੀਗੜ੍ਹ ਅਤੇ ਫਤਹਿਗੜ੍ਹ ਸਾਹਿਬ ਅਨੰਦਪੁਰ ਸਾਹਿਬ ਸਮਰਾਲੇ ਲੁਧਿਆਣੇ ਸਾਰੇ ਕਿਤੇ ਜੋ ਹੈ ਇਹਦੀ ਵਰਤੋਂ ਹੁੰਦੀ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਹ ਭਾਸ਼ਾ ਸਮਝਣਾ ਬਹੁਤ ਹੀ ਇਜ਼ੀ ਹੋ ਜਾਂਦਾ ਹੈ ਅਤੇ ਜੋ ਜੋ ਕੀ ਹੈ

ਇਸਨੂੰ ਪੜ੍ਹਨਾ ਇਸਨੂੰ ਸਮਝਣਾ ਬਹੁਤ ਈਜ਼ੀ ਹੋ ਜਾਂਦਾ ਹੈ ਸਾਡੇ ਵਪਾਰਾਂ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ